ਹਾਂਜੀ ਸਰਕਾਰ ਵੱਲੋਂ ਵੱਖ ਵੱਖ ਸਮੇਂ ਦੌਰਾਨ ਬਿਮਾਰੀਆਂ ਦੇ ਬਾਰੇ ਵਿੱਦਿਅਕ ਅਤੇ ਜਾਗਰੂਕਤਾ ਪ੍ਰੋਗਰਾਮ ਚਲਾਏ ਗਏ ਹਨ ਜੋ ਕਿ ਆਮ ਲੋਕਾਂ ਦੇ ਲਈ ਕਾਫ਼ੀ ਜ਼ਿਆਦਾ ਲਾਹੇਵੰਦ ਹੋਏ ਹਨ ਜਿਵੇਂ ਕਿ ਆਪਾਂ ਨੂੰ ਪਤਾ ਕਰੋਨਾ ਟਾਈਮ 'ਤੇ ਲੋਕਾਂ ਨੂੰ ਕਿਵੇਂ ਜਾਗਰੂਕ ਕੀਤਾ ਉਹਨਾਂ ਨੇ ਕਿਵੇਂ ਆਪਾਂ ਜਿਹੜਾ ਕਰੋਨਾ ਤੋਂ ਬਚਣ ਦੇ ਲਈ ਕਿਹੜੇ ਕਿਹੜੀਆਂ ਪਰਹੇਜ਼ ਰੱਖਣੇ ਆ ਉਹ ਟੀ ਵੀ ਦੇ ਉੱਪਰ ਵੀ ਆਮ ਤੌਰ 'ਤੇ ਜਿਹੜਾ ਪਿੰਡਾ ਜਾਂ ਸ਼ਹਿਰਾਂ ਦੇ ਵਿੱਚ ਵੀ ਵੀ ਜਿਹੜਾ ਕੀ ਹੈ ਗਲੀ ਗਲੀ ਜਾ ਕੇ ਇੱਕ ਸੰਦੇਸ਼ ਮੋਬਾਇਲ ਫੋਨਾਂ ਦੇ ਰਾਹੀਂ ਪਹੁੰਚਾਇਆ ਗਿਆ ਵੀ ਇਹਨਾਂ ਬਿਮਾਰੀਆਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਸਮੇਂ ਸਮੇਂ ਅਨੁਸਾਰ ਸਰਕਾਰ ਦੁਆਰਾ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਗਏ ਹਨ ਜਿਸ ਦਾ ਲੋਕਾਂ ਨੇ ਵੱਧ ਤੋਂ ਵੱਧ ਫ਼ਾਇਦਾ ਉਠਾਇਆ ਹੈ ਇਸ ਕਰਕੇ ਜਿਵੇਂ ਹੁਣ ਅੱਜ ਕੱਲ੍ਹ ਮਲੇਰੀਆ ਜਾਂ ਮੱਛਰ ਵਗੈਰਾ ਜਾਂ ਇਹਦੇ ਲਈ ਜਿਹੜੇ ਆਪਣੇ ਡਿਸਪੈਂਸਰੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਹੁੰਦੀਆਂ ਉਹ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਕਰਦੀਆਂ ਗੀਆਂ ਸਮੇਂ ਸਮੇਂ ਲੋਕਾਂ ਨੂੰ ਜਿਹੜਾ ਕੀ ਹੈ ਆਉਣ ਵਾਲੀਆਂ ਬਿਮਾਰੀਆਂ ਦੇ ਨਾਲ ਆਪਾਂ ਕਿਵੇਂ ਲੜਨਾ ਕਿਵੇਂ ਜੂਝਣਾ ਇਹ ਸਾਰਾ ਕੁਝ ਸਿਖਾਇਆ ਜਾਂਦਾ ਹੈ